ਹੈਲੋ ਸਰ ਮੇਰਾ ਇੱਕ ਦੋਸਤ ਹੈ ਤਜਿੰਦਰ ਉੱਥੇ ਆ ਕੇ ਸੰਕਲਪ ਤੁਹਾਡੇ ਰੈਸਟੋਰੈਂਟ 'ਚ ਆ ਕੇ ਨਾ ਡੋਸਾ ਖਾ ਕੇ ਗਿਆ ਸੀ ਪਰਸੋਂ ਰਵਾ ਡੋਸਾ ਤਾਂ ਉਹਨੂੰ ਉਹ ਬਾਹਲਾ ਪਸੰਦ ਆਇਆ ਤਾਂ ਮੈਂ ਉਹਨਾਂ ਦੇ ਲਈ ਆਰਡਰ ਕਰਨਾ ਚਾਹੁੰਦਾ ਉਹ ਗੁਰੂ ਗੁਰੂ ਤੇਗ ਬਹਾਦਰ ਨਗਰ ਗੁਰੂ ਤੇਗ ਬਹਾਦਰ ਨਗਰ ਤਿੰਨ ਨੰਬਰ ਗਲੀ 'ਚ ਮਕਾਨ ਨੰਬਰ ਸੋਲ੍ਹਾਂ 'ਚ ਰਹਿੰਦਾ ਹੈ ਘਰ ਨੰਬਰ ਸੋਲ੍ਹਾਂ ਅਤੇ ਉੱਥੇ ਔਡਰ ਕਰਨਾ ਅਤੇ ਤੁਸੀਂ ਮੇਰਾ ਔਡਰ ਲੈ ਲਓ ਅਤੇ ਉਹਦੇ ਤੁਸੀਂ ਦੋ ਡੱਬੇ ਦੋ ਪੈਕਟ ਹਾਂਜੀ ਪੂਰਾ ਅਤੇ ਨਾਲੇ ਸਾਰਾ ਜਿੰਨੀ ਵੀ ਐਸਸਰੀ ਤੁਸੀਂ ਦਿੰਦੇ ਹੁੰਦੇ ਹੋ ਸਾਰੀਆਂ ਅਸੈਸਰੀਆਂ ਤੁਸੀਂ ਨਾਲ ਪਾ ਦਿਓ ਅਤੇ ਵਧੀਆ ਪੈਕਿੰਗ ਕਰਕੇ ਲੀਕ ਨਾ ਹੋਵੇ ਵਿੱਚ ਵਧੀਆ ਪੈਕਿੰਗ ਕਰਕੇ ਗਰਮਾ ਗਰਮ ਉੱਥੇ ਤੁਸੀਂ ਪਹੁੰਚਾ ਦਿਓ ਅਤੇ ਤੁਸੀਂ ਉੱਥੇ ਪਹੁੰਚ ਕੇ ਗਲੀ ਅੱਗੇ ਉਹਦੀ ਗਲੀ ਦੇ ਵਿੱਚ ਪਹੁੰਚ ਕੇ ਅਤੇ ਤੁਸੀਂ ਉਹਨੂੰ ਫੋਨ ਨਾ ਕਰਿਓ ਤੁਸੀਂ ਮੈਨੂੰ ਮੇਰੇ ਨੰਬਰ ਦੀ ਫੋਨ ਲਾ ਲਿਓ ਅਤੇ ਮੈਂ ਤੁਹਾਨੂੰ ਦੱਸ ਦਊਗਾ ਉਹ ਮੈਂ ਉਹਨੂੰ ਫੋਨ ਕਰ ਦਊਗਾ ਬਾਹਰ ਆ ਕੇ ਤੁਹਾਡੇ ਤੋਂ ਔਡਰ ਲੈ ਲਊਗਾ ਜੀ ਅਤੇ ਇਹ ਚੀਜ਼ ਤੁਸੀਂ ਅੱਧੇ ਘੰਟੇ 'ਚ ਕਰ ਦਿਓ ਸਰ ਥੈਂਕ ਯੂ